ਅਤੇ ਮੈਂ ਤੁਹਾਨੂੰ ਇਹੀ ਇਸ ਬਾਰੇ ਸ਼ਿਕਾਇਤ ਕਰ ਰਹੀ ਹਾਂ ਕਿ ਤੁਸੀਂ ਜੋ ਵੀ ਆਪਣਾ ਔਡਰ ਅੱਗੇ ਤੋਂ ਅੱਗੇ ਦਿੰਦੇ ਹੋ ਕਿਰਪਾ ਇੱਕ ਵਾਰੀ ਚੰਗੀ ਤਰ੍ਹਾਂ ਚੈੱਕ ਕਰ ਲਿਆ ਕਰੋ ਅਤੇ ਨਾਲੇ ਨਾਮ ਵਗੈਰਾ ਸਾਰਾ ਧਿਆਨ ਨਾਲ ਦੇਖ ਲਿਆ ਕਰੋ ਠੀਕ ਹੈ ਨਾ ਇਸ ਲਈ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਸਾਰੇ ਜਿੰਨੇ ਵੀ ਮੈਨੂੰ ਮੇਰਾ ਔਡਰ ਪਲੀਜ਼ ਜਲਦ ਤੋਂ ਜਲਦ ਇਹ ਰਿਟਨ ਕਰਨਾ ਚਾਹੁੰਦੀ ਹਾਂ ਮੈਂ ਅਤੇ ਮੈਨੂੰ ਮੇਰਾ ਚੀਜ਼ ਪਿਜ਼ਾ ਦਿੱਤਾ ਜਾਵੇ